ਅੱਜ ਦੇ ਸਮੇਂ ਵਿੱਚ ਸਾਈਬਰ ਧੱਕੇਸ਼ਾਹੀ ਬਹੁਤ ਜ਼ਿਆਦਾ ਹੋ ਰਹੀ ਹੈ ਜਿਵੇਂ ਕਿ ਦੇਖਦੇ ਹਾਂ ਕਿ ਅਲੱਗ ਅਲੱਗ ਕੰਟਰੀਆਂ ਤੋਂ ਫੋਨ ਆਉਂਦੇ ਹਨ ਜੋ ਕਹਿੰਦੇ ਹਨ ਕਿ ਤੁਹਾਨੂੰ ਇਨਾਮ ਮਿਲਿਆ ਹੈ ਇਸ ਤਰ੍ਹਾਂ ਕਰਨ ਨਾਲ ਉਹ ਸਾਡੇ ਸਾਰੇ ਪੈਸੇ ਅਕਾਊਂਟ 'ਚੋਂ ਲੈ ਜਾਂਦੇ ਹਨ ਇਹ ਬਹੁਤ ਹੀ ਧੱਕੇਸ਼ਾਹੀ ਹੋ ਰਹੀ ਹੈ ਇਹਦੇ ਨਾਲ਼ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬਹੁਤ ਲੋਕ ਇਹਨੂੰ ਦੇਖਦੇ ਹੋਏ ਹੋਰ ਵੈਬਸਾਈਟਾਂ 'ਤੇ ਜਾਣਾ ਛੱਡ ਦਿੰਦੇ ਆ ਜੋ ਕਿ ਜ਼ਰੂਰੀ ਹੁੰਦੀਆਂ ਹਨ ਇਹਨੂੰ ਨਜਿੱਠਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ 'ਤੇ ਨੱਥ ਪਾਉਣੀ ਚਾਹੀਦੀ ਹਨ ਜੋ ਸਾਡੇ ਲਈ ਬੁਰਾ ਪ੍ਰਭਾਵ ਪੈਦਾ ਕਰਦੀ ਹੈ